ਪੰਜਾਬ ਵਿੱਚ ਕਈ ਪ੍ਰਮੁੱਖ ਤੈਕਨੋਲਜੀ ਪਾਰਕ ਅਤੇ ਇਨਕਯੂਬੇਟਰ ਹਨ ਜੋ ਤੈਕਨੋਲੋਜੀ ਕਾਰੋਬਾਰਾਂ ਦੇ ਵਿਕਾਸ ਦਾ ਸਮਰਥਨ ਕਰਦੇ ਹਨ ਪਨਕੌਮ ਜੋ ਕਿ ਚੰਡੀਗੜ੍ਹ ਵਿੱਚ ਸਥਿਤ ਹੈ ਟੈਲੀਕੋਮਨੀਕੇਸ਼ਨ ਅਤੇ ਆਈ ਟੀ ਖੇਤਰ ਵਿੱਚ ਕਈ ਨਵੇਂ ਵਪਾਰਾਂ ਨੂੰ ਉਤਸ਼ਾਹਿਤ ਕਰਦਾ ਹੈ ਐਸ ਟੀ ਪੀ ਆਇ ਮੋਹਾਲੀ ਸੋਫਟਵੇਅਰ ਟੈਕਨੋਲੋਜੀ ਪਾਰਕ ਜੋ ਮੋਹਾਲੀ ਵਿੱਚ ਸਥਿਤ ਹੈ ਸੋਫਟਵੇਅਰ ਇੰਡਸਟਰੀ ਨੂੰ ਬਹੁਤ ਸਾਰੀਆਂ ਸਹੂਲਤਾਂ ਅਤੇ ਸਹਾਇਤਾ ਪ੍ਰਦਾਨ ਕਰਦਾ ਹੈ ਜਿਵੇਂ ਕਿ ਇਨਕਯੂਬੇਸ਼ਨ ਸੇਵਾਵਾਂ ਸੋਫਟਵੇਅਰ ਡਿਵੈਲਪਮੈਂਟ ਅਤੇ ਆਈ ਟੀ ਉੱਨਤੀ ਸਹਾਇਤਾ ਅੰਮ੍ਰਿਤਸਰ ਦਾ ਸੋਫਟਵੇਅਰ ਟੈਕਨੋਲਜੀ ਪਾਰਕ ਵੀ ਇੱਕ ਮਹੱਤਵਪੂਰਨ ਸਥਾਨ ਹੈ ਜੋ ਨਵੇਂ ਟੈਕਨੋਲਜੀ ਕਾਰੋਬਾਰਾਂ ਲਈ ਜਗ੍ਹਾ ਪ੍ਰੋਜੈਕਟ ਸਮਰਥਨ ਅਤੇ ਟੈਕਨੀਕਲ ਮਦਦ ਪ੍ਰਦਾਨ ਕਰਦਾ ਹੈ ਇਹ ਟੈਕਨੋਲਜੀ ਪਾਰਕ ਨਵੇਂ ਵਪਾਰਾਂ ਨੂੰ ਉੱਨਤ ਪਲੇਟਫਾਰਮ ਅਤੇ ਵਪਾਰ ਸਹਾਇਤਾ ਸੇਵਾਵਾਂ ਦੇਖ ਕੇ ਉਹਨਾਂ ਦੇ ਵਿਕਾਸ ਵਿੱਚ ਮਦਦ ਕਰਦੇ ਹਨ